ਮੈਂ ਸਿੰਗਿੰਗ ਨਹੀਂ ਕਰਦੀ ਮੈਂ ਗੁਰੂਆਂ ਗੁਰੂਆਂ ਦੀਆਂ ਢਾਡੀ ਵਾਰਾਂ ਗਾਉਦੀ ਹਾਂ ਜਦੋਂ ਅਸੀਂ ਢਾਡੀ ਵਾਰਾਂ ਦੀ ਤਿਆਰੀ ਕਰਦੇ ਹਾਂ ਤਾਂ ਅਸੀਂ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਉਸਨੂੰ ਕਾਪੀ ਉੱਤੇ ਸਾਫ਼ ਸਾਫ਼ ਲਿਖਦੇ ਹਾਂ ਜਿਸਦੀ ਅਸੀਂ ਤਿਆਰੀ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਦੋ ਤਿੰਨ ਘੰਟੇ ਲਗਾਤਾਰ ਬੈਠ ਕੇ ਉਸਨੂੰ ਸ਼ੁੱਧ ਕਰਕੇ ਉਸਨੂੰ ਸਾਜ਼ਾਂ ਦੇ ਉੱਤੇ ਗਾਉਣ ਦੀ ਤਿਆਰੀ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਆਪਣਾ ਇੱਕ ਗਰੁੱਪ ਬਣਾ ਕੇ ਗਰੁੱਪ ਬਣਾ ਕੇ ਅਸੀਂ ਇੱਕ ਇੱਕ ਮਿੱਕ ਹੋ ਕੇ ਗਾਉਂਦੇ ਹਾਂ ਉਸ ਤੋਂ ਬਾਅਦ ਅਸੀਂ ਉਸੇ ਜੋ ਜਿਸਦੀ ਅਸੀਂ ਤਿਆਰੀ ਕੀਤੀ ਹੁੰਦੀ ਹੈ ਉਸਨੂੰ ਅਸੀਂ ਸਟੇਜ ਦੇ ਉੱਤੇ ਗਾਉਣ ਦੀ ਸਹੀ ਅਤੇ ਵਧੀਆ ਢੰਗ ਨਾਲ ਗਾਉਣ ਦੀ ਤਿਆਰੀ ਕਰਕੇ ਜੋ ਜਾਣਦੇ ਹਾਂ ਉਸਨੂੰ ਸਹੀ ਢੰਗ ਨਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਗਰ ਫਿਰ ਵੀ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਅਸੀਂ ਉਸਨੂੰ ਘਰ ਆ ਕੇ ਦੁਬਾਰਾ ਤੋਂ ਫਿਰ ਇੱਕ ਜਗ੍ਹਾ ਬੈਠ ਕੇ ਗਰੁੱਪ ਵਿੱਚ ਬੈਠ ਕੇ ਦੁਬਾਰਾ ਤੋਂ ਤਿਆਰੀ ਕਰਦੇ ਹਾਂ ਅਤੇ ਵਧੀਆ ਗਾਉਣ ਦੇ ਵਧੀਆ ਗਾਉਣ ਦਾ ਕੋਸ਼ਿਸ਼ ਕਰਦੇ ਹਾਂ